ਮੈਂ ਆਪਣੇ ਗੁਆਂਢ ਵਿੱਚ ਰਹਿੰਦੇ ਇੱਕ ਮਿੱਤਰ ਨੂੰ ਬਗੀਚਾ ਲਗਾਉਣ ਵਿੱਚ ਮਦਦ ਕੀਤੀ ਉਹਨਾਂ ਨੇ ਮੈਨੂੰ ਪੁੱਛਿਆ ਕਿ ਸਾਨੂੰ ਕਿਸ ਤਰ੍ਹਾਂ ਦੇ ਪੌਦੇ ਲਗਾਉਣੇ ਚਾਹੀਦੇ ਹਨ ਜਿਸ ਵਿੱਚ ਸਾਨੂੰ ਉਹਨਾਂ ਦੀ ਸਾਂਭ ਸੰਭਾਲ 'ਤੇ ਵੀ ਕੋਈ ਜ਼ਿਆਦਾ ਸਮਾਂ ਨਾ ਲਗਾਉਣਾ ਪਵੇ ਅਤੇ ਬਹੁਤ ਹੀ ਘੱਟ ਕੀਮਤ 'ਤੇ ਅਸੀਂ ਆਪਣੀ ਬਗੀਚੇ ਨੂੰ ਹਰਾ ਭਰਾ ਅਤੇ ਸੁੰਦਰ ਬਣਾ ਸਕੀਏ ਤਾਂ ਮੈਂ ਉਹਨਾਂ ਨੂੰ ਕਈ ਤਰ੍ਹਾਂ ਦੇ ਸੁਝਾਅ ਦਿੱਤੇ ਕਿਉਂਕਿ ਸਾਡੇ ਕੋਲ ਸਮਾਂ ਵੀ ਐਨਾ ਨਹੀਂ ਹੁੰਦਾ ਕਿ ਅਸੀਂ ਬਗੀਚੇ 'ਤੇ ਜ਼ਿਆਦਾ ਸਮਾਂ ਲਗਾ ਸਕੀਏ ਅਸੀਂ ਸ ਸਿਰਫ ਸੁ ਸੁਬਾਹ ਇੱਕ ਘੰਟਾ ਜਾਂ ਸ਼ਾਮ ਨੂੰ ਦੋ ਘੰਟੇ ਲਗਾ ਸਕਦੇ ਹਾਂ ਉਹਨਾਂ ਨੂੰ ਮੈਂ ਉਸ ਤਰ੍ਹਾਂ ਦੇ ਸੁਝਾਅ ਦਿੱਤੇ ਕਿ ਸਾਨੂੰ ਕਿਹੜੇ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਕਿ ਕਿੰਨੀ ਕੀਮਤ ਤੱਕ ਦੇ ਪੌਦੇ ਸਾਨੂੰ ਵੱਧ ਫਲ ਅਤੇ ਫੁੱਲ ਦੇ ਸਕਦੇ ਹਨ